ਪੰਜਾਬ ਦਾ ਸੱਭਿਆਚਾਰ ਅਤੇ ਇਸ ਦੇ ਇਤਿਹਾਸ ਦੇ ਮਤਲਬ ਜੇ ਗੱਲ ਕਰੀਏ ਤਾਂ ਇਸ ਸਮੇਂ ਪ ਪਹਿਲਾਂ ਪੰਜਾਬ ਵਿੱਚ ਮੁਗਲਾਂ ਦੀ ਮਤਲਬ ਕਾਫੀ ਚ ਚਲਦੀ ਹੁੰਦੀ ਤੀ ਉਸ ਸਮੇਂ ਜਦ ਮੁਗਲ ਸਮਰਾਜ ਕਰਕੇ ਲੋਕਾਂ ਵਿੱਚ ਖਾਣ ਪੀਣ ਰਹਿਣ ਸਹਿਣ ਵਿੱਚ ਕਾਫੀ ਫਰਕ ਪਿਆ ਉਹਨਾਂ ਨੇ ਕਾਫੀ ਕੁਝ ਚੇਂਜ ਕਰਤਾ ਫਿਰ ਜਦ ਵੀ ਪੰਜਾਬ ਵਿੱਚ ਕੋਈ ਆਇਆ ਉਹਨੇ ਮਤਲਬ ਸੱਭਿਆਚਾਰ ਨੂੰ ਬਦਲਣ ਦੀ ਕੋਸ਼ਿਸ਼ ਕਰੀ ਉਹ ਇਹ ਸੋਚਦਾ ਸੀ ਕਿ ਮਤਲਬ ਇੱਥੇ ਦਾ ਮਤਲਬ ਜਿੰਨਾਂ ਕੁਛ ਵੀ ਆ ਉਹ ਮੇਰੇ ਅਨੁਸਾਰ ਚੱਲੇ ਅਤੇ ਜਿੰਨੇ ਲੋਕ ਵੀ ਉੱਥੇ ਆਏ ਜਿਹੜੇ ਵੀ ਆਏ ਉਸ ਆਹੀ ਸੋਚਦੇ ਸੀ ਕਿ ਹੁਣ ਅਸੀਂ ਇੱਦਾਂ ਦਾ ਕੁਛ ਕਰੀਏ ਕਿ ਸਾਡੇ ਅਨੁਸਾਰ ਇੱਥੇ ਸਭ ਕੁਛ ਬਣ ਜਾਵੇ ਜਿੰਨੇ ਵੀ ਜਿੱਦਾਂ ਹੁਣ ਉਸ ਤੋਂ ਬਾਅਦ ਸਿੱਖ ਵੀ ਆਏ ਉਹਨਾਂ ਉਹਨਾਂ ਨੇ ਵੀ ਇਹੀ ਸੋਚਿਆ ਕਿ ਆਪਣਾ ਇੱਥੇ ਮਤਲਬ ਆਪਣਾ ਰਾਜ ਹੋਏ ਅਤੇ ਉਹਨਾਂ ਨੇ ਵੀ ਕਾਫੀ ਕੁਛ ਬਦਲਾਵ ਕਰੇ